ਸ਼੍ਰੋਮਣੀ ਪ੍ਰਬੰਧਕ ਕਮੇਟੀ ਸਾਡੇ ਆਗੂ ਗਿਆਨੀ ਰਘਵੀਰ ਸਿੰਘ ਜੀ ਹਨ ਉਹ ਸਾਡੇ ਪ੍ਰਚਾਰਕ ਹਨ ਉਹ ਸਾਨੂੰ ਘਰ ਘਰ ਜਾ ਕੇ ਪ੍ਰਚਾਰ ਕਰਦੇ ਨੇ ਜੇਕਰ ਗੱਲ ਕਰੀਏ ਤਾਂ ਹਿੰਦੂ ਧਰਮ ਦੀ ਤਾਂ ਸਵਾਮੀ ਰਾਮਾ ਨੰਦ ਜੀ ਵੀ ਘਰ ਘਰ ਜਾ ਕੇ ਪ੍ਰਕਾ ਪ੍ਰਚਾਰ ਧਰਮ ਦੇ ਪ੍ਰਚਾਰ ਕਰਦੇ ਹਨ ਉਨ੍ਹਾਂ ਨੇ ਵੀ ਹਿੰਦੂ ਸੰਸਥਾਵਾਂ ਨੂੰ ਬਹੁਤ ਵਧਾਇਆ ਹੈ